ਮੈਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨਾ ਬਹੁਤ ਚੰਗਾ ਲੱਗਦਾ ਹੈ ਮੈਂ ਜਦੋਂ ਵੀ ਆਪਣੇ ਵਿਹਲੇ ਸਮੇਂ ਦੇ ਵਿੱਚ ਆਪਣੀ ਸਕੂਲ ਦੀ ਲਾਇਬ੍ਰੇਰੀ ਜਾਂ ਫਿਰ ਕੋਲੇਜ ਦੀ ਲਾਇਬ੍ਰੇਰੀ ਵਿੱਚ ਜਾ ਕੇ ਕਿਤਾਬਾਂ ਹੀ ਪੜ੍ਹਦੀ ਹਾਂ ਮੈਨੂੰ ਵੱਖ ਵੱਖ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਪਰ ਮੈਨੂੰ ਉਹਨਾਂ ਵਿੱਚੋਂ ਇੱਕ ਕਿਤਾਬ ਚਾਣਕਿਆ ਨੀਤੀ ਪਹਿਲਾਂ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਉਸ ਵਿੱਚ ਔਰਤਾਂ ਦੇ ਵਿਰੁੱਧ ਬਹੁਤ ਕੁਛ ਬੋਲਿਆ ਗਿਆ ਸੀ ਉਹ ਕਹਿੰਦੇ ਸੀ ਕਿ ਹਰ ਮੁਸੀਬਤ ਦੀ ਜੜ੍ਹ ਇੱਕ ਔਰਤ ਹੀ ਹੈ ਅਗਰ ਅਸੀਂ ਔਰਤ ਦੇ ਮੋਹ ਵਿੱਚ ਹਾਂ ਤਾਂ ਅਸੀਂ ਕੁਛ ਵੀ ਨਹੀਂ ਬਣ ਸਕਦੇ ਉਹਨਾਂ ਨੇ ਉਹਨਾਂ ਦਾ ਹਮੇਸ਼ਾ ਨਤੀਜਾ ਇਹ ਹੀ ਨਿਕਲਦਾ ਸੀ ਹ ਕੋਈ ਵੀ ਮੁਸੀਬਤ ਹੈ ਜਾਂ ਕੋਈ ਵੀ ਸਾਡੀ ਜ਼ਿੰਦਗੀ ਦੇ ਵਿੱਚ ਸਮੱਸਿਆ ਹੈ ਉਸ ਦੀ ਜੜ੍ਹ ਇੱਕ ਔਰਤ ਹੀ ਹੈ ਪਰ ਬਾਅਦ ਵਿੱਚ ਜਦੋਂ ਮੈਂ ਹੌਲੀ ਹੌਲੀ ਇਹ ਕਿਤਾਬ ਪੜ੍ਹੀ ਤਾਂ ਮੈਨੂੰ ਇਹ ਬਹੁਤ ਚੰਗੀ ਲੱਗਣ ਲੱਗ ਪਈ ਕਿਉਂਕਿ ਇਸ ਵਿੱਚ ਮੇਰੀ ਜ਼ਿੰਦਗੀ ਦੇ ਇਹੋ ਜਿਹੇ ਸਵਾਲਾਂ ਦੇ ਜਵਾਬ ਸੀ ਜੋ ਮੈਂ ਕਦੋਂ ਤੋਂ ਲੱਭ ਰਹੀ ਸੀ ਉਹਨਾਂ ਦੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਬਹੁਤ ਸੌਖਾ ਮਹਿਸੂਸ ਕੀਤਾ ਮੈਨੂੰ ਉਸ ਵਿੱਚੋਂ ਆਪਣੀ ਅਸਲ ਜ਼ਿੰਦਗੀ ਕੀ ਹੈ ਉਹਦਾ ਪਤਾ ਲੱਗਿਆ ਅਤੇ ਉਹਨਾਂ ਦੀਆਂ ਗੱਲਾਂ ਨਾਲ ਇਹ ਪਤਾ ਲੱਗਿਆ ਕਿ ਆਪਾਂ ਕਿਸ ਤਰ੍ਹਾਂ ਕੋਈ ਵੀ ਮੁਕਾਮ ਉੱਤੇ ਜਾ ਸਕਦੇ ਹਾਂ ਅਤੇ ਕੋਈ ਵੀ ਚੀਜ਼ ਨੂੰ ਹਾਸਿਲ ਕਰ ਸਕਦੇ ਹਾਂ ਉਹਨਾਂ ਦੀ ਕਿਤਾਬ ਨਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਫ਼ਾਇਦੇ ਹੋਏ ਹਨ ਜਿਵੇਂ ਕਿ ਮੈਨੂੰ ਪਤਾ ਲੱਗਿਆ ਕਿ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਕੀ ਹੈ ਅਤੇ ਅਸੀਂ ਇਸ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਇਹ ਚੀਜ਼ਾਂ ਨਾਲ ਮੈਂ ਆਪਣੇ ਹਰ ਹਰ ਜਗ੍ਹਾ ਦੇ ਵਿੱਚ ਪ੍ਰਥਮ ਸਥਾਨ ਹਾਸਿਲ ਕੀਤਾ ਅਤੇ ਆਪਣੀ ਜ਼ਿੰਦਗੀ ਨੂੰ ਬਹੁਤ ਸਹੀ ਰਸਤੇ ਜਾਂਦੇ ਵੇਖਿਆ ਉਹਨਾਂ ਦੀ ਸੋਚ ਦੇ ਨਾਲ ਉਹਨਾਂ ਦੀ ਸੋਚ ਦੇ ਨਾਲ ਮੇਰੀ ਸੋਚ ਵਿੱਚ ਵੀ ਬਹੁਤ ਫ਼ਰਕ ਆਉਣ ਲੱਗ ਪਿਆ ਅਤੇ ਮੈਨੂੰ ਇਸ ਦੇ ਨਾਲ ਆਪਣੀ ਹੋਰ ਵਧੀਆ ਤਰ੍ਹਾਂ ਕੰਮ ਕਰਨ ਦੀ ਕਾਬਲੀਅਤ ਬਾਰੇ ਪਤਾ ਲੱਗਿਆ ਮੈਨੂੰ ਬਹੁਤ ਕੁਝ ਪਤਾ ਲੱਗਿਆ ਕਿ ਮੈਂ ਕਿਸ ਤਰ੍ਹਾਂ ਆਪਣੇ